ਪਹਿਲਾਂ ਮੈਨੂੰ ਫੋਟੋਗ੍ਰਾਫੀ ਦਾ ਬਿਲਕੁਲ ਸ਼ੌਕ ਨਹੀਂ ਸੀ ਜਦੋਂ ਦੋ ਕੁ ਸਾਲ ਪਹਿਲਾਂ ਮੈਂ ਖੁਦ ਦਾ ਫੋਨ ਲਿਆ ਤਾਂ ਮੈਨੂੰ ਦੂਸਰਿਆਂ ਨੂੰ ਦੇਖ ਕੇ ਮੇਰਾ ਵੀ ਦਿਲ ਕੀਤਾ ਕਿ ਮੈਂ ਵੀ ਫੋਟੋ ਖਿਚਾਵਾਂ ਫਿਰ ਮੈਂ ਹੌਲੀ ਹੌਲੀ ਫੋਟੋ ਖਿਚਾਉਣਾ ਸਟਾਰਟ ਕੀਤਾ ਪ ਉਸ ਟਾਈਮ ਜਦੋਂ ਮੈਂ ਫਸਟ ਟਾਈਮ ਖਿਚਾਈਆਂ ਤਾਂ ਇੰਨੀਆਂ ਵਧੀਆ ਨਹੀਂ ਖਿੱਚ ਸ ਖਿੱਚ ਹੋਈਆਂ ਕਿਉਂਕਿ ਉਸ ਬਾਰੇ ਮੈਨੂੰ ਨੌਲੇਜ ਬਿਲਕੁਲ ਨਹੀਂ ਸੀ ਜਦੋਂ ਮੈਂ ਉਸਨੂੰ ਸਿੱਖਣਾ ਸਟਾਰਟ ਕੀਤਾ ਤਾਂ ਮੇਰਾ ਦਿਲਚਸਪੀ ਹੋਰ ਵੱਧ ਗਈ ਕਿ ਮੈਂ ਹੋਰ ਸਿੱਖਾਂ ਫਿਰ ਮੈਂ ਉਸਨੂੰ ਐਡਿਟ ਕਰਨਾ ਸਿਖਿਆ ਜਦੋਂ ਮੈਨੂੰ ਐਡੀਟਿੰਗ ਆ ਗਈ ਤਾਂ ਮੇਰੇ ਘਰਦੇ ਹੋ ਗਿਆ ਫਰੈਂਡਸ ਹੋ ਗਏ ਉਹ ਸਾਰੇ ਮੇਰੇ ਤੋਂ ਫੋਟੋਸ ਕਲਿੱਕ ਕਰਵਾਉਂਦੇ ਸੀ ਅਤੇ ਮੈਂ ਐਡਿਟ ਉਹਨਾਂ ਦੀ ਕਰਦੀ ਸੀ ਅਤੇ ਉਹ ਮੈਨੂੰ ਹੀ ਹਰ ਵਾਰ ਕੋਲ ਕਰਦੇ ਸੀ ਕੀ ਫੋਟੋਸ ਵਗੈਰਾ ਖਿੱਚ ਦੇ ਜਾਂ ਫਿਰ ਮੈਂ ਕਿਤੇ ਜਾਂਦੀ ਸੀ ਜਾਂ ਮੈਂ ਉੱਥੇ ਦੀ ਨੇਚਰ ਦੀ ਫੋਟੋ ਹੋ ਗਈ ਕੋਈ ਵੀ ਮੈਨੂੰ ਚੀਜ਼ ਦਿੱਖ ਜੇ ਜਿਵੇਂ ਬਰਡਜ਼ ਦਿਖ ਜਾਂਦੇ ਆ ਕੁਛ ਵੀ ਅਲੱਗ ਦਿਖੇ ਤਾਂ ਮੈਂ ਉਸਦੀ ਫੋਟੋ ਕਲਿੱਕ ਕਰਕੇ ਉਹਨੂੰ ਐਡਿਟ ਕਰ ਲੈਂਦੀ ਹਾਂ ਅਤੇ ਮੈਂ ਸੋਚਿਆ ਜੇ ਇੰਨ ਫਿਊਚਰ ਮੈਨੂੰ ਮੌਕਾ ਕੋਈ ਵੀ ਮਿਲੇ ਤਾਂ ਮੈਂ ਫੋਟੋਗ੍ਰਾਫਰੀ ਜ਼ਰੂਰ ਕਰਾਂਗੀ